ਹਾਂਜੀ ਭਾਅ ਜੀ ਮੈਂ ਤੁਹਾਨੂੰ ਪੁੱਛਣਾ ਸੀ ਕਿ ਕਿੰਨਾ ਟਾਈਮ ਲੱਗੇਗਾ ਪਹੁੰਚਣ ਲਈ ਬਹੁਤ ਟਾਈਮ ਹੋ ਰਿਹਾ ਮੈਂ ਬਹੁਤ ਜ਼ਿਆਦਾ ਲੇਟ ਹੋ ਰਹੀ ਹਾਂ ਮੈਂ ਆਪਣੀ ਮੀਟਿੰਗ 'ਤੇ ਜ਼ਰੂਰੀ ਪਹੁੰਚਣਾ ਮੈਨੂੰ ਨਾ ਬਹੁਤ ਡਾਂਟ ਪੈ ਜਾਣੀ ਹੈ ਜੇ ਮੈਂ ਉੱਥੇ ਟਾਈਮ ਸਿਰ ਨਾ ਪਹੁੰਚੀ ਦਸ ਦਿਉ ਕਿੰਨਾ ਟਾਈਮ ਲੱਗੇਗਾ ਅੱਛਾ ਘੰਟਾ ਲੱਗ ਜਾਏਗਾ ਭਾਅ ਜੀ ਇੰਨਾ ਟਾਈਮ ਤਾਂ ਨਹੀਂ ਹੈਗਾ ਮੇਰੇ ਕੋਲ ਘੰਟੇ 'ਚ ਤਾਂ ਮੈਂ ਉੱਥੇ ਮੀਟਿੰਗ ਮੁੱਕਾ ਕੇ ਆ ਜਾਂਦੀ ਜੇਕਰ ਮੈਨੂੰ ਪਤਾ ਹੁੰਦਾ ਤਾਂ ਮੈਂ ਤੁਹਾਨੂੰ ਇਹ ਰੂਟ 'ਤੇ ਆਉਣ ਹੀ ਨਹੀਂ ਸੀ ਦੇਣਾ ਇੱਥੇ ਤਾਂ ਕੰਮ ਹੋ ਰਿਹਾ ਦੇਖੋ ਤੁਸੀਂ ਇੱਥੇ ਤਾਂ ਬਹੁਤ ਟਾਈਮ ਲੱਗ ਜਾਏਗਾ ਸੜਕ ਕੰਮ ਸੜਕ ਦਾ ਨਿਰਮਾਣ ਹੋ ਰਿਹਾ ਅਤੇ ਤੁਸੀਂ ਟਰੈਫਿਕ ਦੇਖੋ ਬੰਦ ਹੈ ਰਸਤਾ ਭਾਅ ਜੀ ਦੇਖ ਲੈਣਾ ਚਾਹੀਦਾ ਸੀ ਤੁਹਾਨੂੰ ਇਹ ਰਸਤੇ ਤੋਂ ਤੁਸੀਂ ਨਹੀਂ ਸੀ ਲੈ ਕੇ ਆਉਣਾ ਮੈਨੂੰ ਦੇਖੋ ਜੇਕਰ ਕੋਈ ਹੋਰ ਰਸਤਾ ਮਿਲਿਆ ਤਾਂ ਉੱਥੋਂ ਲੈ ਜਾਓ ਮੈਨੂੰ ਹੈ ਮੇਰਾ ਵੀਰ ਉੱਥੋਂ ਲੈ ਜਾਓ ਅੱਛਾ ਮੈਂ ਗੂਗਲ ਮੈਪਸ 'ਤੇ ਵੀ ਚੈੱਕ ਕੀਤਾ ਜੇਕਰ ਅਸੀਂ ਇੱਥੋਂ ਲੈ ਕੇ ਵੀ ਜਾਂਦੇ ਹਾਂ ਤਾਂ ਘੱਟੋ ਘੱਟ ਘੰਟਾ ਟਰੈਫਿਕ 'ਚ ਹੀ ਫਸ ਜਾਣਾ ਆਪਾਂ ਅਤੇ ਭਾਅ ਜੀ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਜਾਂ ਤਾਂ ਤੁਸੀਂ ਇੱਕ ਕੰਮ ਕਰੋ ਇੱਕ ਕੰਮ ਕਰੋ ਮੈਨੂੰ ਥੋੜ੍ਹਾ ਜਿਹਾ ਤਾਂ ਘੁਮਾਕੇ ਪਿੱਛੇ ਛੱਡ ਦਿਉ ਅਤੇ ਮੈਂ ਉੱਥੋਂ ਅੱਧਾ ਕੁ ਘੰਟਾ ਮੈਨੂੰ ਲੱਗੇਗਾ ਮੈਂ ਆਪੇ ਚਲ ਜਾਂਗੀ ਪੈਸੇ ਤੁਹਾਨੂੰ ਪੂਰੇ ਦੇ ਦਾਂਗੀ ਮੈਨੂੰ ਲਾਹ ਦਿਉ ਬਸ ਚੰਗਾ ਠੀਕ ਹੈ